ਸਕੂਲ ਅਤੇ ਕੋਲਿਜ ਦੋਨਾਂ ਦੇ ਵਿੱਚ ਹੀ ਜਿਹੜਾ ਚਿੱਤਰਕਾਰੀ ਹੈ ਉਹ ਸਾਨੂੰ ਇੱਕ ਅਲੱਗ ਤੋਂ ਵਿਸ਼ਾ ਹੈ ਅਤੇ ਜਿਹੜੇ ਸਾਡੇ ਚਿੱਤਰਕਾਰੀ ਦੇ ਜਿਹੜੇ ਸਾਡੇ ਅਧਿਆਪਕ ਸਨ ਉਹ ਸਾਨੂੰ ਸ਼ੁਰੂ ਤੋਂ ਹੀ ਉਹਨਾਂ ਨੇ ਬਹੁਤ ਜ਼ਿਆਦਾ ਗਾਈਡ ਕੀਤਾ ਜਾਂ ਸਾਨੂੰ ਬਹੁਤ ਹੀ ਹੌਂਸਲਾ ਸ਼ੁਰੂ ਤੋਂ ਹੀ ਦਿੰਦੇ ਆਏ ਨੇ ਅਤੇ ਕਲਾਕਾਰਾਂ ਦੀ ਮਦਦ ਕਰਨ ਦੇ ਲਈ ਜਿਹੜਾ ਸਾਡਾ ਕੋਲਿਜ ਹੈ ਜੋ ਹਮੇਸ਼ਾਂ ਹੀ ਕੋਈ ਨਾ ਕੋਈ ਵੱਖ ਵੱਖ ਹੈ ਜਿਹੜੇ ਕੋਂਪੀਟੀਸ਼ਨ ਹੈ ਜਾਂ ਕੋਈ ਨਾ ਕੋਈ ਈਵੈਂਟ ਹੈ ਜਿਹੜੇ ਔਰਗਨਾਈਜ਼ ਕਰਾਉਂਦਾ ਹੀ ਰਹਿੰਦਾ ਹੈ ਜਿੱਦਾਂ ਕਿ ਕੋਈ ਪੋਸਟਰ ਮੇਕਿੰਗ ਕੋਂਪੀਟੀਸ਼ਨ ਆ ਗਿਆ ਜਾਂ ਕੋਈ ਚਿੱਤਰਕਾਰੀ ਵਾਲਾ ਹੋਰ ਈਵੈਂਟ ਆ ਗਿਆ ਅਤੇ ਇਹਨਾਂ ਸਭ ਕੋਂਪੀਟੀਸ਼ਨਸ ਨੂੰ ਭਾਗ ਇ ਇਹਨਾਂ ਵਿੱਚ ਭਾਗ ਲੈ ਲੈ ਕੇ ਜਿਹੜਾ ਜਿਹੜਾ ਆਪਣਾ ਇੱਕ ਟਿੱਚਾ ਹੈ ਜਿਹੜਾ ਮੈਨੂੰ ਲੱਗਦਾ ਹੈ ਕਿ ਆਪਾਂ ਮਿੱਥ ਸਕਦੇ ਹਾਂ ਅਸੀਂ ਉਹ ਉਸ ਟਿੱਚੇ ਤੱਕ ਪਹੁੰਚ ਸਕਦੇ ਹਾਂ ਅਤੇ ਹਮੇਸ਼ਾਂ ਮੇਰੀ ਸ਼ੁਰੂ ਤੋਂ ਇਹ ਹੀ ਯੋਜਨਾ ਰਹੀਂ ਹੈ ਕਿ ਜੇ ਆਪਾਂ ਇਨ੍ਹਾਂ ਫੰਕਸ਼ਨਾਂ ਦੇ ਵਿੱਚ ਵੀ ਪਾਰਟੀਸਪੇਟ ਕਰਾਂਗੇ ਤਾਂ ਆਪਾਂ ਬਹੁਤ ਜ਼ਿਆਦਾ ਅੱਗੇ ਵੱਧ ਸਕਦੇ ਹਾਂ ਅਤੇ ਆਪਣੀ ਜਿਹੜੀ ਕਲਾ ਹੈ ਉਸਨੂੰ ਨਿਖਾਰ ਸਕਦੇ ਹਾਂ